ਅਸੀਂ ਤਾਰਿਆਂ ਤੋਂ ਵਿਗਿਆਨਿਕ ਮਾਧਿਅਮ ਵਿੱਚ ਬਹੁਤ ਸਿੱਖਿਆ ਲੈ ਸਕਦੇ ਹਾਂ ਤਾਂ ਤਾਰਿਆਂ ਜੋ ਤਾਰਾ ਮੰਡਲ ਹੈ ਉਹ ਮਿਲ ਕੇ ਕਾਫੀ ਸਾਰੀਆਂ ਅਕ੍ਰਿਤੀਆਂ ਬਣਾਉਂਦਾ ਹੈ ਜਿਵੇਂ ਕਿ ਧਨੁਸ਼ ਬਣਾਉਂਦਾ ਹੈ ਕਈ ਵਾਰੀ ਇਨਸਾਨ ਦੀ ਪ੍ਰਤਿਮਾ ਬਣੀ ਹੁੰਦੀ ਹੈ ਫਿਰ ਹੋਰ ਵੀ ਅਲੱਗ ਅਲੱਗ ਤਰ੍ਹਾਂ ਦੇ ਬਹੁਤ ਸਾਰੀਆਂ ਪ੍ਰਤਿਮਾ ਬਣਦੀਆਂ ਅਸੀਂ ਵੇਖ ਹੀ ਸਕਦੇ ਹਾਂ ਧਰੁਵ ਤਾਰਾ ਹੁੰਦਾ ਇੱਕ ਜੋ ਕਿ ਅਲੱਗ ਹੀ ਚਮਕਦਾ ਆ ਉਸ ਦਾ ਸਾਈਜ਼ ਵੀ ਥੋੜ੍ਹਾ ਵੱਡਾ ਹੁੰਦਾ ਬਾਕੀ ਤਾਰਿਆਂ ਨਾਲੋਂ ਇਸ ਦੇ ਨਾਲ ਹੀ ਅਸੀਂ ਪੂਰਵ ਦਿਸ਼ਾ ਦਾ ਵੀ ਅਨੁਮਾਨ ਲਗਾ ਸਕਦੇ ਹਾਂ ਧਰੁਵ ਤਾਰਾ ਇੱਕ ਹੀ ਜਗ੍ਹਾ 'ਤੇ ਰਹਿੰਦਾ ਜਿਹਦੇ ਕਰਕੇ ਅਸੀਂ ਉਹਨੂੰ ਧਰੁਵ ਤਾਰਾ ਵੀ ਕਹਿੰਦੇ ਹਾਂ ਧਰੁਵ ਇਹਦੇ ਬਾਰੇ ਤਾਰਾ ਮੰਡਲ ਬਾਰੇ ਬਾਕੀ ਬਹੁਤ ਜ਼ਿਆਦਾ ਪੜ੍ਹਾਈ ਵੀ ਹੁੰਦੀ ਆ ਸਕੂਲਾਂ ਵਿੱਚ ਦਸਵੀਂ ਕਲਾਸ ਵਿੱਚ ਬਹੁਤ ਜ਼ਿਆਦਾ ਤਾਰਾ ਮੰਡਲ ਬਾਰੇ ਪੜ੍ਹਾਈ ਹੁੰਦੀ ਆ